ਵਿਗਿਆਪਨ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਤਰੀਕੇ ਹਨ ਜਿਵੇਂ ਅਖਬਾਰਾਂ ਅਖਬਾਰਾਂ ਆਮ ਤੌਰ 'ਤੇ ਅਖਬਾਰਾਂ 'ਤੇ ਆਮ ਤੌਰ 'ਤੇ ਹਰ ਕੋਈ ਵਿਗਿਆਪਨ ਕਰਕੇ ਇਸ਼ਤਿਹਾਰ ਪਾਉਂਦਾ ਹੀ ਪਾਉਂਦਾ ਹੈ ਪਰ ਇਸ ਤੋਂ ਇਲਾਵਾ ਅੱਜ ਕੱਲ੍ਹ ਟੈਕਨੋਲੋਜੀ ਐਨੀ ਵੱਧ ਚੁੱਕੀ ਹੈ ਕਿ ਇੰਟਰਨੈੱਟ ਸੋਟ ਸੋਸ਼ਲ ਮੀਡੀਆ ਅਤੇ ਹੋਰ ਵੀ ਕੁਝ ਬਥੇ ਵਧੇਰੇ ਇਹੋ ਜਿਹੇ ਤਰੀਕੇ ਹਨ ਜਿਨ੍ਹਾਂ ਲੋਕ ਵਿਗਿਆਪਨ ਦੂਰ ਤੱਕ ਪਹੁੰਚਾ ਸਕਦੇ ਹਨ ਅਤੇ ਬਹੁਤ ਅਸਾਨੀ ਨਾਲ ਲੋਕਾਂ ਤੱਕ ਪਹੁੰਚ ਜਾਂਦੇ ਹਨ ਕੁਛ ਜਿਹੜਾ ਮੇਰਾ ਰੋ ਰਚਨਾਤਮਕ ਪ੍ਰਭਾਵਸ਼ਾਲੀ ਵਿਗਿਆਪਨ ਸੀ ਕੁਛ ਸਮੇਂ ਪਹਿਲਾਂ ਸਕਾਈ ਅਕੈਡਮੀ ਵੱਲੋਂ ਕੈਟ ਇਗਜ਼ਾਮ ਦੀ ਤਿਆਰੀ ਕਰਵਾਈ ਜਾ ਰਹੀ ਸੀ ਜਿਸਦੀ ਫੀਸ ਪੰਜਾਹ ਹਜ਼ਾਰ ਤੱਕ ਸੀ ਪਰ ਓ ਸਰ ਨੇ ਕੁੜੀਆਂ ਲਈ ਮੁਫ਼ਤ ਪੜ੍ਹਾਈ ਕਰਕੇ ਉਹਨਾਂ ਨੂੰ ਫ੍ਰੀ ਵਿੱਚ ਕੈਟ ਦੀ ਤਿਆਰੀ ਕਰਵਾਉਣ ਦਾ ਸੋਚਿਆ ਅਤੇ ਇਹ ਮੇਰੇ ਲਈ ਇੱਕ ਰਾ ਰਚ ਰਚਨਾਤਮਕ ਪ੍ਰਭਾਵਸ਼ਾਲੀ ਵਿਗਿਆਪਨ ਸੀ